ਗੈਰੇਜ ਵੈਨ ਕਾਰ ਜੀਪ ਮੋਟਰਬਾਇਕ ਮੋਟਰਸਾਈਕਲ ਸਕੂਟਰ ਟੈਕਸੀ ਬੱਸ ਐਂਬੂਲੈਂਸ ਕਾਰਾਵੇਨ ਕੋਚ ਬਾਈਸਾਈਕਲ ਟ੍ਰਾਈਸਾਈਕਲ ਪੈਡੀਕੈਬ ਡਬਲ ਡੇਕਲ ਬੱਸ ਕਨਵਰਟੇਬਲ ਕਾਰ ਪੁਲਿਸ ਕਾਰ ਫੋਰਮਲ ਕਾਰ ਪਿਕਅਪ ਟਰੱਕਸ ਓਟੋ ਰਿਕਸ਼ਾਸ ਕੁਆਡ ਫ਼ਾਇਰ ਇੰਜਣ ਕਰੇਨ ਫੋਰਕਲਿਫਟ ਮੈਨਲੇ ਟਰੈਕਟਰ ਟਰੱਕ ਡਮਪਰ ਟਰੱਕ ਬੁਲਡੋਜ਼ਰ ਐਕਸ ਐਕਸਕੇਬੇਟਰ ਰੋਡ ਰੋਲਰ ਸੀਮੈਂਟ ਮਿਕਸਰ ਟ੍ਰੇਨ ਵੈਗਨ ਵਹੀਕਲ ਬੋਟ ਹੋਵਰਕਰਾਫਟ ਟਰੈਮ ਹੋਟ ਏਅਰ ਬਲੂਨ ਏਅਰਕਰਾਫਟ ਜੈਟ ਪਲੈਨਸ ਸਪੇਸਕਰਾਫਟ ਹੈਲੀਕੋਪਟਰ ਲੋਕੋਮੋਟਿਵ ਸਬਵੇ ਗ੍ਰਿਲਡਰ ਸਬਮੈਰੀਨ ਸ਼ਿਪ